ਮੇਰੀ ਅੱਜ ਤੱਕ ਦੀ ਸਭ ਤੋਂ ਮਾਣ ਵਾਲੀ ਪ੍ਰਾਪਤੀ ਇਹ ਹੈ ਕਿ ਇੱਕ ਵਾਰ ਮੈਂ ਜਦੋਂ ਸੜਕ 'ਤੇ ਜਾ ਰਿਹਾ ਸੀਗਾ ਤਾਂ ਇੱਕ ਵਾਹਨ ਨੇ ਇੱਕ ਕੁੱਤੇ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਕੁੱਤਾ ਘਾਇਲ ਹੋ ਗਿਆ ਅਤੇ ਉਹ ਦਰਦਨਾਕ ਤੜਫ਼ ਰਿਹਾ ਸੀ ਅਤੇ ਉਸ ਦਾ ਖੂਨ ਵੀ ਕਾਫੀ ਵਹਿ ਚੁੱਕਿਆ ਸੀ ਜਿਸ ਨੂੰ ਵੇਖ ਕੇ ਮੈਨੂੰ ਕਾਫੀ ਤਰਸ ਆਇਆ ਅਤੇ ਮੈਂ ਉੱਥੇ ਰੁਕਿਆ ਅਤੇ ਉਸ ਘਾਇਲ ਕੁੱਤੇ ਨੂੰ ਪਾਣੀ ਪਿਲਾਇਆ ਅਤੇ ਉਸ ਦਾ ਖੂਨ ਵਗੈਰਾ ਪੂੰ ਪੂੰ ਸਾਫ਼ ਕੀਤਾ ਅਤੇ ਮੈਨੂੰ ਥੋੜ੍ਹੀ ਬਹੁਤ ਉਹਨਾਂ ਦੀ ਜਾਣਕਾਰੀ ਵੀ ਸੀਗੀ ਅਤੇ ਫਿਰ ਮੈਂ ਉਹਨਾਂ ਨੂੰ ਇੰਜੈਕਸ਼ਨ ਵਗੈਰਾ ਦਿੱਤਾ ਉਸ ਤੋਂ ਬਾਅਦ ਮੈਂ ਆਪਣੇ ਨਜ਼ਦੀਕੀ ਸਰਕਾਰੀ ਜਾਨਵਰ ਹਸਪਤਾਲ ਵਿੱਚ ਕਾਲ ਕੀਤੀ ਅਤੇ ਉਹ ਉਸ ਨੂੰ ਲੈਣ ਆਏ ਉਸ ਨੂੰ ਲੈਣ ਆਏ ਅਤੇ ਉਸ ਤੋਂ ਬਾਅਦ ਉਸ ਉਸ ਦੀ ਜਾਨ ਬਚ ਗਈ ਉਸ ਦੀ ਜਾਨ ਬਚ ਗਈ ਜਿਸ ਕਰਕੇ ਉਸ ਦੀ ਜਾਨ ਬਚਾ ਕੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਅੱਜ ਤੱਕ ਦੀ ਮੇਰੀ ਸਭ ਤੋਂ ਮਾਣ ਵਾਲੀ ਪ੍ਰਾਪਤੀ ਇਹੋ ਸੀ